ਹੈਲੋ ਸਤਿ ਸ਼੍ਰੀ ਅਕਾਲ ਜੀ ਜੇਕਰ ਤੁਸੀਂ ਲਾਲ ਕੋਠੇ 'ਤੇ ਮੈਨੇਜਰ ਬੋਲ ਰਹੇ ਹੋ ਮੈਂ ਸੁਣਿਆ ਸੀ ਕਿ ਇੱਥੇ ਪੰਦਰਾਂ ਤਾਰੀਖ ਨੂੰ ਸਤਿੰਦਰ ਸਰਤਾਜ ਦਾ ਸੰਗੀਤ ਉਤਸਵ ਹੋਣਾ ਹੈ ਕੀ ਮੈਂ ਸਹੀ ਸੁਣਿਆ ਇਹ ਉਹ ਮੇਰੇ ਮਨਪਸੰਦ ਗਾਇਕ ਹਨ ਮੈਂ ਅੱਜ ਤੱਕ ਕਦੇ ਵੀ ਕੋਈ ਲਾਈਵ ਸੰਗੀਤ ਉਤਸਵ ਨਹੀਂ ਵੇਖਿਆ ਇਹ ਮੇਰੀ ਦਿਲੀ ਇੱਛਾ ਸੀ ਕਿ ਮੈਂ ਉਹਨਾਂ ਦਾ ਲਾਈਵ ਸੰਗੀਤ ਸੁਣਾ ਕਿਉਂਕਿ ਉਹ ਮੈਂ ਉਹਨਾਂ ਦੀ ਬਹੁਤ ਵੱਡੀ ਫੈਨ ਹਾਂ ਉਹਨਾਂ ਦੇ ਬਹੁਤ ਗਾਣੇ ਸੁਣੇ ਆ ਜਿਵੇਂ ਕਸੀਦਾ ਗੁਰਮੁਖੀ ਦਾ ਬੇਟਾ ਉਡਾਰੀਆਂ ਅਤੇ ਹੋਰ ਵੀ ਬਹੁਤ ਤਾਂ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦੀ ਸੀ ਕਿ ਜੇ ਮੈਂ ਇਸ ਸੰਗੀਤ ਉਤਸਵ ਵਿੱਚ ਆਉਂਦੀ ਹਾਂ ਤਾਂ ਕੀ ਇਹ ਮੇਰੇ ਸਮੇਂ ਅਤੇ ਮੇਰੇ ਪੈਸੇ ਨੂੰ ਮੁੱਲ ਪਾਵੇਗਾ ਓਕੇ ਤਾਂ ਫਿਰ ਇਸ ਦੀਆਂ ਟਾਈਮਿੰਗਸ ਕੀ ਹਨ ਅੱਛਾ ਚਾਰ ਵਜੇ ਤੋਂ ਠੀਕ ਹੈ ਅਤੇ ਮੈਂ ਫਿਰ ਟਿਕਟਸ ਕਿੱਥੋਂ ਲੈ ਸਕਦੀ ਹਾਂ ਓਕੇ ਇੰਟਰਨੈਟ ਤੋਂ ਤੁਹਾਡੇ ਕੋਲ ਦੋਵੇਂ ਓਕੇ ਓਕੇ ਅਤੇ ਫਿਰ ਮੈਨੂੰ ਫ਼ਾਇਦਾ ਕਿੱਥੋਂ ਹੋਵੇਗਾ ਜੇ ਮੈਂ ਇੰਟਰਨੈਟ ਲਵਾਂ ਉੱਥੋਂ ਜਾਂ ਫਿਰ ਜੇ ਤੁਹਾਡੇ ਕੋਲ ਲਵਾਂ ਉੱਥੋਂ ਜੇ ਮੈਂ ਜੇ ਮੈਂ ਆਪਣੇ ਹੋਰ ਵੀ ਦੋ ਤਿੰਨ ਜਣਿਆ ਦੀ ਲੈਣੀ ਹੋਵੇ ਤਾਂ ਕੁਛ ਡਿਸਕਾਊਂਟ ਵਗੈਰਾ ਹੈ ਜਾਂ ਨਹੀਂ ਅੱਛਾ ਜੀ ਓਕੇ ਓਕੇ ਟਵੈਂਟੀ ਪ੍ਰਸੈਂਟ ਡਿਸਕਾਊਂਟ ਮਿਲੇਗਾ ਓਕੇ ਅਤੇ ਇਹ ਕਿੱਥੇ ਹੋਣਾ ਇਹ ਹਾਂਜੀ ਕਿਹੜੇ ਹਾਲ 'ਚ ਹੈ ਓਕੇ ਦੂਜੇ ਹਾਲ 'ਚ ਓਕੇ ਓਕੇ ਹਾਂਜੀ ਠੀਕ ਹੈ ਓਕੇ ਥੈਂਕ ਯੂ ਧੰਨਵਾਦ ਜੀ